ਬੱਚਿਆਂ ਲਈ ਬਹੁਤ ਸਾਰੇ ਭਾਗ ਉਪਲਬਧ ਹਨ ਅਖ਼ਬਾਰ ਵਿੱਚ ਜਿਵੇਂ ਕਿ ਆਈ ਟੀ ਆਈ ਟੀ ਡਿਵੈ ਆਈ ਟੀ ਸੈਕਟਰ ਦੇ ਪੇਜਿਸ ਦਿੱਤੇ ਹੁੰਦੇ ਨੇ ਉਹਦੇ 'ਤੇ ਬੱਚਿਆਂ ਲਈ ਉਹ 'ਚ ਉਹਦੇ ਵਿੱਚ ਬੱਚਿਆਂ ਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਜਿਵੇਂ ਕਿ ਉਹਨਾਂ ਦੀ ਟੈਕਨੋਲੋਜੀ ਦੇ ਬਾਰੇ ਨਵੀਂ ਨਵੀਂ ਟੈਕਨੋਲੋਜੀ ਬਾਰੇ ਉਹਨਾਂ ਨੂੰ ਨੌਲੇਜ ਮਿਲਦੀ ਹੈ ਬਹੁਤ ਹੋਰ ਵੀ ਬਹੁਤ ਬਹੁਤ ਇਨੋਵੇਸ਼ਨਸ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ ਬਹੁਤ ਕੁਛ ਅ ਨਵਾਂ ਟੈਕਨੋਲੋਜੀ 'ਚ ਜੋ ਵੀ ਕੁਝ ਵੀ ਨਵਾਂ ਚੱਲ ਰਿਹਾ ਹੁੰਦਾ ਹੈ ਆਈ ਟੀ ਸੈਕਟਰ ਆਈ ਟੀ ਵਲਡ 'ਚ ਕੁਛ ਵੀ ਉਹਨਾਂ ਨੂੰ ਹਰ ਇੱਕ ਨੌਲੇਜ ਪ੍ਰਾਪਤ ਹੁੰਦੀ ਹੈ ਔਰ ਬਹੁਤ ਇਨਫੋਰਮੇਟਿਵ ਹੁੰਦਾ ਹੈ ਬੱਚਿਆਂ ਲਈ ਉਹ ਹਰ ਇੱਕ ਚੀਜ਼ ਅਤੇ ਵੀਕਐਂਡ ਵਿੱਚ ਕ ਬੱਚਿਆਂ ਵੀਕਐਂਡ 'ਤੇ ਅਖ਼ਬਾਰ ਵਿੱਚ ਬੱਚਿਆਂ ਨੂੰ ਹ ਵੀਕ 'ਤੇ ਐਂਡ 'ਤੇ ਬੱਚਿਆਂ ਲਈ ਅਖ਼ਬਾਰ ਵਿੱਚ ਬਹੁਤ ਹੀ ਇੱਕ ਛੋਟੀ ਦੁਨੀਆ ਜਿਵੇਂ ਇੱਕ ਛੋਟੀ ਦੁਨੀਆ ਦੀ ਵੱਖਰੀ ਇੱਕ ਬੁੱਕ ਕੌਮਿਕ ਉਹਦੇ ਵਿੱਚ ਬਹੁਤ ਸਾਰੇ ਕੌਮਿਕਸ ਹੁੰਦੇ ਨੇ ਬਹੁਤ ਸਾਰੇ ਚੁਟਕੁਲੇ ਹੁੰਦੇ ਨੇ ਜੋ ਕਿ ਬੱਚਿਆਂ ਦਾ ਮਨੋਰੰਜਨ ਕਰਦੇ ਨੇ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਨੇ ਜਿਹਦੇ ਪਿੱਛੇ ਇੱਕ ਮੋਰਲ ਛਿਪਿਆ ਹੁੰਦਾ ਹੈ ਇੱਕ ਮਹੱਤਵ ਹੁੰਦਾ ਹੈ ਉਹਦਾ ਇੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਹੁੰਦੀ ਉਹਦੇ ਵਿੱਚ ਸਟੋਰੀ ਦੇ ਪਿੱਛੇ ਇੱਕ ਸਿੱਖਿਆ ਸਿਖਾਈ ਹੁੰਦੀ ਹੈ ਉਹ ਬੱਚਿਆਂ ਨੂੰ ਦੇਖਣ ਨੂੰ ਮਿਲਦੀ ਹੈ ਬੱਚੇ ਬਹੁਤ ਹੀ ਆਨੰਦ ਮਾਣਦੇ ਨੇ ਉਸ ਚੀਜ਼ ਦਾ ਅਤੇ ਉਹਨਾਂ ਨੂੰ ਉਹਦੇ ਵਿੱਚ ਪਜ਼ਲਸ ਦਿੱਤੀਆਂ ਹੁੰਦੀਆਂ ਨੇ ਬੱਚੇ ਪਜ਼ਲ ਸੋਲਵ ਕਰਦੇ ਹਨ ਇਹਦੇ ਨਾਲ ਉਹਨਾਂ ਦਾ ਬ੍ਰੇਨ ਹੋਰ ਸ਼ਾਪ ਹੁੰਦਾ ਹੈ ਅਤੇ ਉਹਨਾਂ ਦਾ ਹੋਰ ਦਿਮਾਗ ਚੱਲਦਾ ਹੈ ਅਤੇ ਉਹ ਆਪਣੇ ਆਪ ਨੂੰ ਹੋਰ ਜ਼ਿਆਦਾ ਇਨਵੋਲਵ ਕਰਦੇ ਨੇ ਇਹਨਾਂ ਚੀਜ਼ਾਂ 'ਚ ਮੈਥਸ ਦੀ ਪਜ਼ਲ ਦਿੱਤੀ ਹੁੰਦੀ ਉਹਦੇ ਵਿੱਚ ਬਹੁਤ ਅੱਛੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਨੇ ਬੱਚਿਆਂ ਨੂੰ ਕੋਮਿਕਸ ਚੁਟਕੁਲੇ ਕਹਾਣੀਆਂ ਇਹ ਸਭ ਦੇਖਣਾ ਪਸੰਦ ਹੁੰਦਾ ਹੈ ਇਸ ਇਨ੍ਹਾਂ ਹੀ ਚੀਜ਼ਾਂ ਕਰਕੇ ਬੱਚਿਆਂ ਦਾ ਰੁਝਾਨ ਨਿਊਜ਼ ਪੇਪਰ ਵੱਲ ਵੱਧਦਾ ਹੈ ਕਿ ਕਿ ਅਸੀਂ ਨਿਊਜ਼ਪੇਪਰ ਰੀਡ ਕਰਨੀ ਹੈ ਇਹਦੇ ਨਾਲ ਉਹਨਾਂ ਦੀ ਸਕਿੱਲ ਸਪੀਕਿੰਗ ਸਕਿੱਲ ਰੀਡਿੰਗ ਸਕਿੱਲ ਵੱਧਦੀ ਹੈ